ਜਿੱਦਾਂ ਕਿ ਸਾਡੇ ਇਲਾਕਿਆਂ ਵਿੱਚ ਅੱਜ ਕੱਲ੍ਹ ਮੁਹੱਲਾ ਕਲੀਨਿਕ ਖੁੱਲ੍ਹ ਗਏ ਹੈ ਇਹ ਪੰਜਾਬ ਪੰਜਾਬ ਸਰਕਾਰ ਦੀ ਮਿਹਰਬਾਨੀ ਹੈ ਜਿਨ੍ਹਾਂ ਨੇ ਸਾਡੇ ਲੋਕਾਂ ਬਾਰੇ ਸੋਚਿਆ ਮੁਹੱਲਾ ਕਲੀਨਿਕ ਸਭ ਤੋਂ ਪਹਿਲਾਂ ਆਪਾਂ ਜਾਂਦੇ ਹਾਂ ਉੱਥੇ ਸਾਨੂੰ ਕੋਈ ਵੀ ਬਿਮਾਰੀ ਹੁੰਦੀ ਹੈ ਕਾਊਂਟਰ 'ਤੇ ਇੱਕ ਪਰਚੀ ਕਟਾਉਂਦੇ ਹਨ ਜਿਹਦੇ ਜਿਹਦੇ ਨਾਲ ਸਾਨੂੰ ਆਧਾਰ ਕਾਰਡ ਦੇਣਾ ਪੈਂਦਾ ਹੈ ਇਹ ਫਰੀ ਪਰਚੀ ਹੁੰਦੀ ਆ ਅਗਰ ਸਾਡੇ ਕੋਲ ਆਧਾਰ ਕਾਰਡ ਹੋਵੇਗਾ ਮੁਹੱਲਾ ਕਲੀਨਿਕ ਜਾ ਕੇ ਅਸੀਂ ਆਪਣੇ ਸਿਹਤ ਦੇ ਰਿਲੇਟਿਡ ਵੱਖਰੇ ਵੱਖਰੇ ਟੈਸਟ ਕਰਵਾ ਸਕਦੇ ਜਿੱਦਾਂ ਕਿ ਆਪਾਂ ਸ਼ੂਗਰ ਦਾ ਟੈਸਟ ਕਰਵਾ ਸਕਦੇ ਹਾਂ ਆਪਾਂ ਆਪਣੇ ਬਲੱਡ ਦਾ ਟੈਸਟ ਕਰਵਾ ਸਕਦੇ ਹੋ ਹੋਰ ਵੀ ਆਪਾਂ ਬਹੁਤ ਟੈਸਟ ਕਰਵਾ ਸਕਦੇ ਹਾਂ ਮੁਹੱਲਾ ਕਲੀਨਿਕ ਜਾ ਕੇ ਮੁਹੱਲਾ ਕਲੀਨਿਕ ਬਹੁਤ ਜ਼ਰੂਰੀ ਹੈ ਇਹ ਉਹਨਾਂ ਲੋਕਾਂ ਲਈ ਹੈ ਜੋ ਲੋਕੀ ਜੋ ਲੋਕ ਵੱਡੇ ਵੱਡੇ ਹਸਪਤਾਲਾਂ ਵਿੱਚ ਨਹੀਂ ਜਾ ਸਕਦੇ